ਫੋਟੋਗ੍ਰਾਫਰ ਇੱਕ ਅਜਿਹਾ ਇਨਸਾਨ ਹੈ ਜਿਹੜੇ ਸਾਨੂੰ ਬਹੁਤ ਅੱਛੇ ਗਿਆਨ ਦਿੰਦਾ ਹੈ ਅਸੀਂ ਉਹਨੂੰ ਬਤੌਰ ਇੱਕ ਰੁੱਖ ਵਾਂਗ ਦੇਖਦੇ ਹਨ ਜਿਹਨੂੰ ਅਸੀਂ ਪਾਲਣਾ ਕਰਨਾ ਚਾਹੁੰਦੇ ਹਨ ਇੱਦਾਂ ਦੇ ਇੱਕ ਫੋਟੋਗ੍ਰਾਫਰ ਹੈ ਸੁਤੇਤ ਸਿੰਘ ਪੰਨੂੰ ਸੁਤੇਤ ਸਿੰਘ ਪੰਨੂ ਜ਼ਿਆਦਾਤਰ ਫੋਤੋਗਰਾਫਰ ਤੋਂ ਅਲੱਗ ਹਨ ਇਹ ਦਰਸ਼ਕਾਂ ਨੂੰ ਨਾ ਕੇਵਲ ਅੰਤਿਮ ਆਊਟਪੁੱਟ ਬਲਕਿ ਇੱਕ ਤਸਵੀਰ ਵਿਕਸਿਤ ਕਰਨ ਵਿੱਚ ਆਪਣੀ ਪ੍ਰਕਿਰਿਆ ਦਿਖਾਉਂਦੇ ਹਨ ਫੋਟੋਗ੍ਰਾਫੀ ਦੀ ਤਕਨੀਕ ਕੀ ਹੈ ਅਤੇ ਕੀ ਨਹੀਂ ਹੈ ਇਹ ਸਭ ਸ਼ਾਮਿਲ ਨਹੀਂ ਕਰਦੇ ਉਸ ਨੂੰ ਆਤਮ ਜਾਗਰੂਕਤਾ ਅਤੇ ਸਹਾਨਭੁਤ ਉੱਤੇ ਵਿਸ਼ੇ ਦੇ ਪ੍ਰਤੀ ਉਹਨਾਂ ਦੇ ਦ੍ਰਿਸ਼ਟੀਕੋਣ ਤੋਂ ਝਲਕਦੀ ਹੈ ਇਹ ਚਿਹਰੇ 'ਤੇ ਭਾਵ ਅਤੇ ਸਰੀਰਕ ਭਾਸ਼ਾ ਦੇ ਪਿੱਛੇ ਸੰਭਾਵਿਤ ਕਾਰਨ ਹੈ ਇਹ ਉਹਨਾਂ ਦੀ ਅੱਖਾਂ ਉਹਨਾਂ ਦੇ ਲੈਂਸ ਅਤੇ ਉਹਨਾਂ ਦੇ ਮਹੱਤਵਪੂਰਨ ਰੂਪ ਹੈ ਜਿਹੜਾ ਕਿ ਉਹਨਾਂ ਦੀ ਫੋਟੋਗ੍ਰਾਫੀ ਨੂੰ ਇੱਕ ਅਹਿਮ ਭੂਮਿਕਾ ਰੱਖਦਾ ਹੈ ਅਤੇ ਉਹਨਾਂ ਦੀ ਰੀਲ ਦੇਖਣਾ ਮੈਨੂੰ ਬਹੁਤ ਪਸੰਦ ਹੈ ਮੈਂ ਉਹਨਾਂ ਨੂੰ ਬਹੁਤ ਪਾਲਣ ਕਰਦੀ ਹਾਂ ਅਤੇ ਬਹੁਤ ਚਿਰ ਤੋਂ ਫੋਲੋ ਕਰਦੇ ਹਾਂ ਅਜਿਹਾ ਇੱਕ ਸ਼ਖਸ ਇੱਕ ਹੋਰ ਹੈਗਾ ਹੈ ਹੀਰਾ ਪੰਜਾਬੀ ਹੀਰਾ ਪੰਜਾਬੀ ਜ਼ਿਆਦਾਤਰ ਜਾਨਵਰਾਂ ਦੀ ਫੋਟੋਗ੍ਰਾਫੀ ਕਰਦਾ ਹੈ ਅਤੇ ਉਹ ਆਪਣੇ ਇਸ ਫੋਟੋਗ੍ਰਾਫੀ ਲਈ ਕੋਈ ਸ਼ੇਰ ਕੋਈ ਡੋਲਫਿਨ ਕੋਈ ਕੁਛ ਨਾ ਕੁਛ ਇੱਦਾਂ ਦਾ ਤਕਨੀਕ 'ਤੇ ਕੁਦਰਤ ਨੂੰ ਸਾਡੇ ਨਾਲ ਜੋੜਦਾ ਹੈ ਜਿਹੜਾ ਕਿ ਸਾਡੀ ਵਾਈਡ ਲਾਈਫ ਨੂੰ ਅੱਗੇ ਲੈ ਕੇ ਜਾਂਦਾ ਹੈ ਅਤੇ ਇਹ ਬਤੌਰ ਫੋਟੋਗ੍ਰਾਫਰ ਸਾਨੂੰ ਆਪਣੀ ਭੂਮਿਕਾ ਦੱਸਦੇ ਹਨ ਇਹ ਦੋ ਮੈਨੂੰ ਬਹੁਤ ਪਸੰਦ ਹਨ ਅਤੇ ਇਹਨਾਂ ਨੂੰ ਪਾਲਣਾ ਕਰਦੇ ਹੋਏ ਮੇਰਾ ਵੀ ਮਨ ਕਰਦਾ ਹੈ ਕਿ ਮੈਂ ਆਪਣੇ ਅੱਖਾਂ ਦੇ ਰਾਹੀਂ ਜਿਹੜੇ ਦ੍ਰਿਸ਼ ਦੇਖੇ ਹਨ ਉਹਨਾਂ ਨੂੰ ਇੱਕ ਪਿਆਰੀ ਜਿਹੀ ਫੋਟੋਗ੍ਰਾਫੀ ਦੇ ਜ਼ਰੀਏ ਇੱਕ ਆਪਣੀ ਕਿਤਾਬਾਂ ਦੀ ਬੁੱਕਲ ਵਿੱਚ ਲਕੋ ਸਕਾ